ਮੈਨੂੰ ਸਿਲਾਈ ਦੇ ਨਾਲ ਨਾਲ ਕਢਾਈ ਕਰਨੀ ਵੀ ਬਹੁਤ ਵਧੀਆ ਲੱਗਦੀ ਹੈ ਸੂਟਾਂ ਉੱਪਰ ਜਿਸ ਵਿੱਚ ਅਸੀਂ ਕਈ ਤਰ੍ਹਾਂ ਦੇ ਟਾਂਕੇ ਇਸਤੇਮਾਲ ਕਰਦੇ ਹਾਂ ਜਿਵੇਂ ਫਿਸ਼ ਬੋਨ ਹੋ ਗਿਆ ਸ਼ੈਡੋ ਹੋ ਗਿਆ ਅਤੇ ਬੂਰ ਵਾਲੀ ਕਢਾਈ ਹੋ ਗਈ ਕਈ ਤਰ੍ਹਾਂ ਦੀਆਂ ਕਢਾਈਆਂ ਸੀ ਬਹੁਤ ਵਾਰ ਕਰੀਆਂ ਪਰ ਇੱਕ ਦੋ ਵਾਰ ਇਸ ਤਰ੍ਹਾਂ ਦੇ ਕਈ ਟਾਂਕੇ ਹੁੰਦੇ ਆ ਜਿਹਨਾਂ ਨੂੰ ਮਤਲਬ ਕਢਾਈ ਕਰਨ ਸਾਨੂੰ ਬਹੁਤ ਪਰੇਸ਼ਾਨੀ ਵੀ ਹੋਈ ਪਰ ਉਹ ਕਰਨਾ ਵੀ ਜ਼ਰੂਰੀ ਸੀ ਕਿਉਂਕਿ ਪਸੰਦ ਬਹੁਤ ਸੀ ਇਸ ਵਿੱਚ ਮੈਨੂੰ ਇੱਕ ਵਾਰ ਪੈਚ ਵਰਕ ਵਿੱਚ ਮੈਂ ਕੁੜਤੇ 'ਤੇ ਕੰਮ ਤਾਂ ਸ਼ੁਰੂ ਕਰ ਲਿਆ ਔਰ ਉਸਨੂੰ ਬਣਾਇਆ ਵੀ ਅਸੀਂ ਪਰ ਉਸ 'ਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਮੇਰੀ ਔਰ ਉਸਨੂੰ ਮਤਲਬ ਕਾਫੀ ਮਿਹਨਤ ਤੋਂ ਬਾਅਦ ਮੈਨੂੰ ਪਹਿਲਾਂ ਤਾਂ ਮੈਨੂੰ ਰੰਗਾਂ ਦਾ ਨਹੀਂ ਕੋਈ ਹਿਸਾਬ ਆ ਰਿਹਾ ਸੀ ਪਰ ਫਿਰ ਉਹ ਪੈਚ ਵਰਕ ਜੋ ਡਿਜ਼ਾਇਨ ਸਾਨੂੰ ਪਸੰਦ ਆ ਰਿਹਾ ਸੀ ਉਹ ਬੜੀ ਮੁਸ਼ਕਿਲ ਨਾਲ ਮੈਂ ਮਤਲਬ ਪੈਚ ਵਰਕ ਉਸ 'ਤੇ ਕਰਿਆ ਅਤੇ ਇੱਕ ਵਾਰ ਇਸੇ ਤਰ੍ਹਾਂ ਮਤਲਬ ਔਰ ਬਣਨ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਉਹ ਬਹੁਤ ਹੀ ਸੋਹਣਾ ਕੁੜਤਾ ਬਣਿਆ ਸੀ ਔਰ ਉਸਨੂੰ ਮਤਲਬ ਜਿਸ ਨੂੰ ਪਾਉਣ ਤੋਂ ਬਾਅਦ ਮੈਨੂੰ ਕਈ ਲੋਕਾਂ ਨੇ ਉਸ ਦੇ ਬਾਰੇ ਕੰਪਲੀਮੈਂਟ ਦਿੱਤੇ ਉਸ ਦੀ ਤਾਰੀਫ ਕਰੀ ਜੋ ਕਿ ਮੈਨੂੰ ਵੀ ਖੁਦ ਨੂੰ ਵੀ ਬਣਾ ਕੇ ਬਹੁਤ ਖੁਸ਼ੀ ਹੋਈ ਕਿਉਂ ਲਗਭਗ ਇੱਕ ਮਹੀਨਾ ਲੱਗ ਗਿਆ ਸੀ ਮੈਨੂੰ ਉਸ ਨੂੰ ਬਣਾਉਣ 'ਤੇ ਪਰ ਕਦੀ ਇੰਨਾ ਟਾਈਮ ਨਹੀਂ ਲੱਗਿਆ ਸੀ ਅਤੇ ਉਹ ਅੱਜ ਤੱਕ ਮੇਰੇ ਯਾਦ ਹੈ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਸੀ ਉਹਨੂੰ ਬਣਾਉਣਾ